ਭਾਰਤ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਵੱਖਰੇ ਵੱਖਰੇ ਲੋਕ ਰਹਿੰਦੇ ਨੇ ਅਤੇ ਉਹਨਾਂ ਦਾ ਵੱਖਰਾ ਵੱਖਰਾ ਫੈਸ਼ਨ ਆ ਪਹਿਲੇ ਸਮੇਂ ਨਾਲੋਂ ਹੁਣ ਦੇ ਸਮੇਂ ਵਿੱਚ ਫੈਸ਼ਨ ਦੇ ਮੁਕਾਬਲੇ ਬਹੁਤ ਜ਼ਿਆਦਾ ਪਰਿਵਰਤਨ ਆਇਆ ਹੈ ਲੋਕ ਜ਼ਿਆਦਾ ਪੱਛਮੀ ਸੱਭਿਆਚਾਰ ਨੂੰ ਜਿਹੜਾ ਆ ਉਹ ਆਪਣੇ ਅੰਦਰ ਢਾਲਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪ ਔਰ ਜੇ ਗੱਲ ਕਰੀਏ ਕਿ ਪੱਛਮੀ ਫੈਸ਼ਨ ਦੀ ਅਤੇ ਪੱਛਮੀ ਫੈਸ਼ਨ ਨੇ ਭਾਰਤ ਵਿੱਚ ਲੋਕਾਂ ਨੂੰ ਅਤੇ ਫੈਸ਼ਨ ਨੂੰ ਬਹੁਤ ਪ੍ਰਭਾਵਿਤ ਕੀਤਾ ਅੱਜ ਕੱਲ੍ਹ ਜਿਹੋ ਜਿਹਾ ਫਿਲਮਾਂ ਬਣ ਰਹੀਆਂ ਨੇ ਉਹਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਨੰਗੇਜ਼ ਔਰ ਫੈਸ਼ਨ ਦੇ ਕੱਪੜੇ ਪਾਏ ਜਾਂਦੇ ਅਤੇ ਲੋਕ ਵੀ ਉਹਨਾਂ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਆਮ ਲੋਕ ਜਿਹੜੇ ਆ ਉਹੋ ਜਿਹਾ ਹੀ ਫੈਸ਼ਨ ਕਰਨ ਲੱਗ ਪੈਂਦੇ ਆ ਸੋ ਗੱਲ ਰਹੀ ਕਿ ਅਸੀਂ ਕਿਸ ਕੱਪੜੇ ਕਿਸਮ ਦੇ ਕੱਪੜੇ ਜਿਹੜੇ ਪਹਿਨਣੇ ਪਸੰਦ ਕਰਦੇ ਹਾਂ ਸਾਨੂੰ ਆਪਣੇ ਇੰਡੀਆ ਦਾ ਜਿਹੜਾ ਮੇਨ ਜਿੱਥੇ ਆਪਾਂ ਰਹਿੰਦੇ ਹਾਂ ਉਹਦੇ ਅਕੋਰਡਿੰਗ ਹੀ ਸਾਨੂੰ ਜਿਹੜੇ ਆ ਕੱਪੜੇ ਪਾਉਣੇ ਪਸੰਦ ਹਨ ਹਰ ਇੱਕ ਇਨਸਾਨ ਜਿਹੜਾ ਵਾ ਉਹਦੀ ਆਪਣੀ ਪਹਿਚਾਣ ਆ ਜੈਸਾ ਦੇਸ਼ ਵੈਸਾ ਭੇਸ ਸੋ ਸਾਨੂੰ ਕਿਸੇ ਦੂਜੀ ਦੇਸ਼ ਪਿੱਛੇ ਲੱਗ ਕੇ ਆਪਣਾ ਫੈਸ਼ਨ ਜਿਹੜਾ ਆ ਪ੍ਰੰਪਰਾਵਾਦੀ ਕੱਪੜੇ ਆ ਜਿਹੜੇ ਉਹ ਨਹੀਂ ਮਤਲਬ ਕਿ ਛੱਡਣੇ ਚਾਹੀਦੇ ਸਗੋਂ ਪਾਉਣੇ ਚਾਹੀਦੇ ਹਨ ਅਤੇ ਅਸੀਂ ਆਪਣੇ ਕੱਪੜੇ ਜਿਹੜੇ ਆ ਉਹ ਇੰਡੀਆ ਦੇ ਵਿੱਚੋਂ ਹੀ ਜ਼ਿਆਦਾ ਖਰੀਦਦੇ ਹਾਂ ਅਤੇ ਇਹਦੇ ਵਿੱਚ ਹੀ ਸਾਨੂੰ ਜਿਹੜੀ ਆ ਉਹ ਖੁਸ਼ੀ ਮਿਲਦੀ ਹੈ ਧੰਨਵਾਦ